ਜੀ ਹਾਂ ਮੈਂ ਵਰਚੁਅਲ ਰਿਐਲਿਟੀ ਗੇਮ ਖੇਡੀ ਹੈ ਮੈਂ ਆਪਣੀ ਪਰਿਵਾਰ ਨਾਲ ਮੋਲ ਘੁੰਮਣ ਗਈ ਸੀ ਤੇ ਮੋਲ ਘੁੰਮਦੇ ਘੁੰਮਦੇ ਮੈਂ ਗੇਮ ਜ਼ੋਨ ਵੀ ਗਈ ਸੀ ਤੇ ਗੇਮ ਜ਼ੋਨ ਵਿੱਚ ਮੈਨੂੰ ਵਰਚੁਅਲ ਰਿਐਲਿਟੀ ਗੇਮ ਖੇਡਣ ਦਾ ਮੌਕਾ ਮਿਲਿਆ

ਵਰਚੁਅਲ ਰਿਐਲਿਟੀ ਗੇਮ ਖੇਡਣ ਲਈ ਸਾਨੂੰ ਅੱਧਾ ਘੰਟਾ ਸਮੇਂ ਮਿਲਿਆ ਤੇ ਉਨਾਂ ਨੇ ਵਰਚੁਅਲ ਰੈਲਿਟੀ ਖੇਡਣ ਤੋਂ ਪਹਿਲਾਂ ਇੱਕ ਸਵਾਲ ਪੁੱਛਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕੀ ਤੁਸੀਂ ਰੇਸਿੰਗ ਕਰਨਾ ਚਾਹੋਗੇ ਜਾਂ ਰੈਸਲਿੰਗ ਖੇਲਣਾ ਚਾਹੋਗੇ ਤਾਂ ਮੈਂ ਰੇਸਿੰਗ ਕਰਨਾ ਪਸੰਦ ਕੀਤਾ ਤਾਂ ਉਹਨਾਂ ਨੇ ਮੈਨੂੰ ਇੱਕ ਮੋਟਰ ਬਾਈਕ ਜਿਹੇ ਜੰਤਰ ਤੇ ਬਿਠਾ ਦਿੱਤਾ ਤੇ ਅੱਖਾਂ ਤੇ ਮੇਰੇ ਵਰਚੁਅਲ ਰਿਐਲਿਟੀ ਜੰਤਰ ਅੱਖਾਂ ਤੇ ਵਰਚੁਅਲ ਰੈਲਿਟੀ ਵਾਲਾ ਜੰਤਰ ਲਗਾਇਆ ਤੇ ਮੇਰੀਆਂ ਅੱਖਾਂ ਤੇ ਬੰਨ ਦਿੱਤਾ ਤੇ ਉਹਨਾਂ ਨੇ ਪਿੱਛੋਂ ਦੀ ਆਨ ਸਕਰੀਨ ਆਨ ਕਰ ਦਿੱਤੀ ਤੇ ਮੋਟਰ ਬਾਈਕ ਵੀ ਓਨ ਕਰ ਦਿੱਤੀ ਤੇ ਤੇ ਜਿੱਦਾ ਜਿੱਦਾ ਮੂਵੀ ਚਲਦੀ ਸੀ ਉਹ ਤਾਂ ਇਦਾਂ ਲੱਗਦਾ ਸੀ ਕਿ ਮੈਂ ਸੱਚੀ ਵਿੱਚ ਉਹ ਉੱਥੇ ਹਾਂ ਮਤਲਬ ਉਹ ਜਿੱਦਾਂ ਜਿੱਦਾਂ ਮੋਟਰ ਬਾਈਕ ਮੂਵੀ ਸਕਰੀਨ ਦੇ ਵਿੱਚ ਮੋੜ ਕੱਟਦਾ ਸੀ ਤਾਂ ਇਦਾਂ ਲੱਗਦਾ ਸੀ ਕਿ ਹਾਂ ਮੈਂ ਖੁਦ ਇਦਾਂ ਚਲਦੀ ਪਈ ਹਾਂ ਜਿਹੜਾ ਮੋਟਰ ਬਾਈਕ ਹੈ ਉਹ ਵੀ ਬਿਲਕੁਲ ਉਦਾਂ ਹੀ ਹਿਲਦਾ ਹੈ ਜਿੱਦਾਂ ਸਕਰੀਨ ਦੇ ਵਿੱਚ ਮੂਵੀ ਚਲਦੀ ਹੁੰਦੀ ਹੈ ਤੇ ਇਸ ਤਰਾਂ ਜਿਹੜਾ ਵਰਚੁਅਲ ਰਿਐਲਿਟੀ ਗੇਮ ਖੇਡਣ ਦਾ ਜਿਹੜਾ ਤਜਰਬਾ ਸੀ ਮੇਰਾ ਬਹੁਤ ਹੀ ਵਧੀਆ ਸੀ ਤੇ ਮੈਨੂੰ ਬਹੁਤ ਹੀ ਮਜ਼ਾ ਆਇਆ ਤੇ ਮੈਂ ਦੁਬਾਰਾ ਉਸਨੂੰ ਖੇਲਣਾ ਚਾਹਿਆ ਤੇ ਮੈਂ ਦੁਬਾਰਾ ਟਿਕਟ ਕਟਵਾਈ ਤੇ ਉਸਨੂੰ ਦੁਬਾਰਾ ਫਿਰ ਖੇਡਿਆ ਪਰ ਉਸ ਸਮੇਂ ਮੈਂ ਮੋਟਰ ਰੇਸਿੰਗ ਨਹੀਂ ਕੀਤੀ ਮੈਂ ਰੈਸਲਿੰਗ ਵੀ ਖੇਡੀ ਮੈਨੂੰ ਰੈਸਲਿੰਗ ਦੇ ਵਿੱਚ ਵੀ ਬਹੁਤ ਮਜ਼ਾ ਆਇਆ ਉਹ ਤੇ ਇਦਾਂ ਲੱਗਦਾ ਹੈ ਕਿ ਤੁਸੀਂ ਸੱਚੀ ਉਸ ਜਗ੍ਹਾ ਦੇ ਵਿੱਚ ਪਹੁੰਚੇ ਹੋਏ ਹੋ ਉਹ ਤੁਹਾਡੀ ਸਕਰੀਨ ਅੱਖਾਂ ਤੇ ਲੱਗ ਜਾਂਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਤੁਸੀਂ ਸੱਚੀ ਉਸ ਜਗ੍ਹਾ ਤੇ ਪਹੁੰਚ ਗਏ ਹੋ ਤਾਂ ਇਸ ਦਾ ਮੇਰਾ ਪਹਿਲਾ ਜਿਹੜਾ ਤਜਰਬਾ ਸੀ ਉਹ ਬਹੁਤ ਹੀ ਵਧੀਆ ਸੀ